ਟੂਲ ਕਿੱਟ ਦੀ ਵਰਤੋਂ ਨਾਲ ਪੈਂਚਰ ਨੂੰ ਸਿੱਧ ਕਰਨਾ ਜਿਹਦੇ ਵਿੱਚ ਟਾਇਰ ਨੂੰ ਟਾਇਰ ਤੋਂ ਟਿਊਬ ਕੱਢਣਾ ਪੈਂਚਰ ਨੂੰ ਲੱਭ ਕੇ ਉਹਦੇ ਉੱਤੇ ਪੈਚ ਲਗਾਉਣਾ ਇਹ ਟਾਇਰ ਨੂੰ ਵਾਪਸ ਫਿਟ ਅਤੇ ਪੰਪ ਨਾਲ ਹਵਾ ਭਰਨਾ ਫਿਰ ਚੇਨ ਦੀ ਦੇਖਭਾਲ ਕਰਨੀ ਕਿ ਜੇਕਰ ਚੇਨ ਢਿੱਲੀ ਹੋਏ ਜਾਂ ਖੜਕਣ ਲੱਗੇ ਤਾਂ ਉਸਨੂੰ ਟਾਈਟ ਕਰਨਾ ਚੇਨ ਦੇ ਲੁਪਰੀਕੈਂਟ ਨਾਲ ਗਰੀਸ ਕਰਨਾ ਉਹਨੂੰ ਤਾਂ ਕਿ ਮੁਲਾਇਮ ਹੋ ਸਕੇ ਜੇ ਚੇਨ ਜ਼ਿਆਦਾ ਘਿਸ ਰਹੀ ਹੋਵੇ ਤਾਂ ਉਸਨੂੰ ਤੁਰੰਤ ਬਦਲਣਾ ਤਾਂ ਕਿ ਸਾਨੂੰ ਸਫਰ ਦੌਰਾਨ ਦਿੱਕਤ ਨਾ ਕਰੇ ਬ੍ਰੇਕ ਸਿਸਟਮ ਦੀ ਜਾਂਚ ਕਰਨੀ ਬ੍ਰੇਕ ਪੈਟਰਲ ਦੀ ਪੁਜ਼ੀਸ਼ਨ ਜਾਂ ਬਦਲਾਓ ਜੇ ਠੀਕ ਨਹੀਂ ਹੈ ਬੈਟਰੀ ਸਮੱਸਿਆਵਾਂ ਜੇਕਰ ਸਾਡੇ ਬਾਈਕ ਦੀ ਬੈਟਰੀ ਖਰਾਬ ਆ ਅਤੇ ਉਸ ਨੂੰ ਜਲਦ ਤੋਂ ਜਲਦ ਬਦਲਣਾ ਅਤੇ ਬੈਟਰੀ 'ਤੇ ਹੈਡਲਾਈਟ ਰਿਫਿਊਜਸ ਦੀ ਜਾਂਚ ਕਰਨੀ ਤਾਂ ਕਿ ਸਾਨੂੰ ਰਾਤ ਨੂੰ ਸਫਰ ਕਰਨ ਲੱਗੇ ਕੋਈ ਦਿੱਕਤ ਜਾਂ ਕੋਈ ਮੁਸ਼ਕਿਲ ਨਾ ਆਵੇ ਕਲੱਚ ਅਤੇ ਗੇਅਰ ਦੀ ਸੈਟਿੰਗ ਵੇਖਣੀ ਕਿ ਕਲਚ ਲੀਵਰ ਜਾਂ ਗਰਿਪ ਜਾਂ ਗੇਅਰ ਸ਼ਿਫਟਿੰਗ ਵੇਲੇ ਕੋਈ ਸਮੱਸਿਆ ਨਾ ਆਵੇ ਸਾਨੂੰ ਉਸਨੂੰ ਫਿਕਸ ਕੀਤਾ ਜਾਵੇ ਇੰਜਨ ਓਇਲ ਚੈੱਕ ਕਰਨਾ ਤਾਂ ਕਿ ਸਾਨੂੰ ਕਿਸੇ ਵੀ ਲੰਬੇ ਸਫਰ ਦੌਰਾਨ ਕੋਈ ਦਿੱਕਤ ਨਾ ਆਵੇ ਤੇਲ ਪੈਟਰੋਲ ਪੂਰਾ ਹੋਣਾ ਆਪਣੀ ਬਾਈਕ ਵਿੱਚ ਤਾਂ ਕਿ ਅਸੀਂ ਆਰਾਮ ਨਾਲ ਆਪਾਂ ਸਫਰ ਤੈਅ ਕਰ ਸਕੀਏ